ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਤੁਸੀਂ ਉਹਦੇ ਅਨੀਕੇਤ ਦੇ ਮੰਮੀ ਬੋਲ ਰਹੇ ਹਾਂਜੀ ਤੁਸੀਂ ਅਨੀਕੇਤ ਦੇ ਪੇਟੀਐਮ 'ਤੇ ਮਲ ਆ ਜਿਓ ਮਲ ਇੱਦਾਂ ਇੱਦਾਂ ਹੈ ਨਾ ਪੀ ਟੀ ਐਮ ਤੁਸੀਂ ਮੈਂ ਕਿਹਾ ਆ ਜਿਓ ਇੱਕ ਵਾਰ ਦੇਖ ਲਿਓ ਅਨੀਕੇਤ ਦੇ ਨੰਬਰ ਵਗੈਰਾ ਹੈ ਨਾ ਇ ਆ ਆ ਜਿਓ ਅੱਜ ਏ ਆ ਜਿਓ ਮੈਂ ਕਹਿੰਦੀ ਹਾਂਜੀ ਤੁਹਾਨੂੰ ਦੱਸ ਦਿੰਦੇ ਨਾ ਉਦੋਂ ਤਾਂ ਤੁਸੀਂ ਨਹੀਂ ਆ ਸਕਦੇ ਤਾਂ ਹਾਂਜੀ ਅਤੇ ਮੈਂ ਦੱਸ ਰਹੀ ਹਾਂ ਕਿ ਅਨੀਕੇਤ ਮਤਲਬ ਜਿੱਦਾਂ ਮੈਂ ਕਰ ਰਹੀ ਦੋ ਮਿੰਟ ਰੁਕਿਓ ਹਾਂਜੀ ਅਨੀਕੇਤ ਦਾ ਮੈਂ ਰਿਜ਼ਲਟ ਕੱਢਿਆ ਹਾਂਜੀ ਹੈ ਨਾ ਹਾਂਜੀ ਬਾਕੀ ਮਤਲਬ ਸਬਜੈਕਟ 'ਚ ਠੀਕ ਹੈ ਬਸ ਥੋੜ੍ਹਾ ਜਿਹਾ ਇੰਗਲਿਸ਼ 'ਚ ਥੋੜ੍ਹਾ ਵੀਕ ਹੈ ਇਹ ਹਾਂਜੀ ਬਾਕੀ ਮੈਥ ਮੂਥ ਤਾਂ ਵਧੀਆ ਕਰ ਲੈਂਦਾ ਹੈ ਨਾ ਤਾਂ ਇੰਗਲਿਸ਼ 'ਚ ਥੋੜ੍ਹਾ ਜਿਹਾ ਇਹਨੂੰ ਪ੍ਰੋਬਲਮ ਆਉਂਦੀ ਇਹਨੂੰ ਪੜ੍ਹਨ 'ਚ ਬੋਲਣ 'ਚ ਧਿਆਨ ਥੋੜ੍ਹਾ ਧਿਆਨ ਦਿਓ ਹੈ ਨਾ ਕਿ ਹਾਂ ਬੱਚਾ ਪੜ੍ਹਦਾ ਕਿਤੇ ਨਹੀਂ ਪੜ੍ਹਦਾ ਧਿਆਨ ਕਰਦਾ ਕਿਉਂਕਿ ਮੰਮੀ ਨੂੰ ਤਾਂ ਪਤਾ ਹੋਣਾ ਚਾਹੀਦਾ ਕਿ ਬੱਚਾ ਕਿੱਦਾਂ ਕਰਦਾ ਪ੍ਰਫੋਰਮੈਸ ਨਹੀਂ ਕਰਦਾ ਹੈ ਨਾ ਤੁਹਾਨੂੰ ਪਤਾ ਹੋਣਾ ਚਾਹੀਦਾ ਹਾਂਜੀ ਅਤੇ ਮੈਂ ਕਹਿਣਾ ਚਾਹੁੰਦੀ ਸੀ ਥੋੜ੍ਹਾ ਟਾਈਮ ਨਾਲ ਬੱਚੇ ਨੂੰ ਭੇਜਿਆ ਕਰੋ ਟਾਈਮ 'ਤੇ ਸਕੂਲ ਹੈ ਨਾ ਹਾਂਜੀ ਕਹਿੰਦੇ ਕਿ ਕਹਿੰਦੇ ਕਿ ਮੰਮੀ ਲੇਟ ਕਰ ਦਿੰਦੇ ਹਾਂ ਇੱਦਾਂ ਉੱਦਾਂ ਹੈ ਨਾ ਹਾਂਜੀ ਬਸ ਇਹ ਨਾ ਕਿ ਇਹ ਨੂੰ ਆਦ ਪ ਡ੍ਰੈੱਸ ਪਰੋਪਰ ਪਾਈ ਹੋਵੇ ਹੈ ਨਾ ਫੁੱਲ ਡ੍ਰੈੱਸ ਹੋਵੇ ਇਹਦੇ ਵਿੱਚ ਤ ਕਦੇ ਸ਼ਰਟ ਪਾ ਲੈਂਦਾ ਕਦੇ ਕੁਛ ਹੈ ਨਾ ਬਹੁਤ ਕੰਮਪਲੇਟ ਹੁੰਦੀ ਹੈ ਜੇ ਚੈੱਕਿੰਗ ਹੁੰਦੀ ਹੈ ਤਾਂ ਤੁਹਾਨੂੰ ਪਤਾ ਹੀ ਹੈ ਹਾਂਜੀ ਚੱਲੋ ਗੱਲ ਇਹ ਹੈ ਨਾ ਕਿ ਬੱਚੇ 'ਤੇ ਥੋੜ੍ਹਾ ਜਿਹਾ ਧਿਆਨ ਦਓ ਹੈ ਨਾ ਬੱਚੇ ਦੇਖੇ ਕਿੱਥੇ ਪੜ੍ਹਦਾ ਕਿ ਨਹੀਂ ਪੜ੍ਹਦਾ ਸਾਰਾ ਦਿਨ ਸਕੂਲ ਵਿੱਚ ਵੀ ਏਦੀਂ ਇੱਧਰ ਉੱਧਰ ਘੁੰਮਦਾ ਰਹਿੰਦਾ ਧਿਆਨ ਨਹੀਂ ਦੇਖਦਾ ਕਿ ਹਾਂ ਮੈਂ ਕਿਹੜਾ ਸਬਜੈਕਟ ਮਤਲਬ ਕਿੱਥੇ ਵੀਕ ਪੁਆਇੰਟ ਹੈ ਨਾ ਮੈਂ ਪੜ੍ਹਨਾ ਹੈ ਹਾਂ ਥੋੜ੍ਹਾ ਥੋੜ੍ਹਾ ਦੇਖੋ ਨਾ ਹਾਂਜੀ ਥੋੜ੍ਹਾ ਦੇਖੋ ਨਾ ਬੱਚਾ ਹਾਂ ਬਾਕੀ ਤੁਸੀਂ ਤੁਹਾਨੂੰ ਪਤਾ ਹੀ ਆ ਕਿ ਬੱਚਾ ਹੁਣ ਪੜ੍ਹੇਗਾ ਤਾਂ ਹੀ ਅੱਗੇ ਜਾ ਕੇ ਫਿਰ ਵਧੂਗਾ ਨਾ ਲਾਈਫ਼ 'ਚ ਆਪਣੇ ਹੈ ਨਾ